ਹੈਲੋ ਹਾ ਹਾਂਜੀ ਹਾਂਜੀ ਨੰਬਰ ਚੋਦਾਂ ਤੋਂ ਬੋਲ ਰਹੀ ਹ ਜੀ ਹਾਂਜੀ ਹਾਂਜੀ ਹਾਂਜੀ ਲੱਸੀ ਦੁੱਧ ਦਹੀਂ ਕੀ ਡੇਅਰੀ ਐ ਹਾਂਜੀ ਦਹੀਂ ਹੁੰਦੀ ਹ ਇਕ ਤਾਂ ਚਾ ਚਾਟੀ ਵਾਲੀ ਦਹੀ ਹੁੰਦੀ ਹੈ ਇਕ ਕੁੰਡੇ ਵਾਲੀ ਦਹੀਂ ਹੁੰਦੀ ਹੈ ਤੇ ਲੱਸੀ ਵੀ ਹੈਗੀ ਆਪਣੇ ਕੋਲੇ ਪੰਜਾਬੀ ਲੱਸੀ ਵੀ ਹੈਗੀ ਹ ਤੇ ਇੱਕ ਉਹ ਵਾਲੀ ਹੁੰਦੀ ਐ ਚਾਟੀ ਵਾਲੀ ਲੱਸੀ ਵੀ ਹੁੰਦੀ ਐ ਦਹੀਂ ਵੀ ਹੁੰਦੀ ਮਤਲਵ ਹਾਂਜੀ ਸਾਰੀ ਲੱਸੀ ਹੁੰਦੀ ਆ ਤੁਸੀਂ ਕਿਹੜੀ ਲੈਣਾ ਪਸੰਦ ਕਰੋਗੇ ਪੁਦੀਨੇ ਵਾਲੀ ਵੀ ਹੁੰਦੀ ਹੈ ਔਰ ਮਿੱਠੀ ਲੱਸੀ ਵੀ ਹੁੰਦੀ ਨਮਕ ਵਾਲੀ ਵੀ ਹੁੰਦੀ ਇਹ ਇੱਕ ਦਸ ਰੁਪਏ ਦਾ ਗਲਾਸ ਇੱਕ ਦਸ ਰੁਪਏ ਦਾ ਗਿਲਾਸ ਛੋਟਾ ਉਸ ਤੋਂ ਵੱਡਾ ਵੀਹ ਰੁਪਏ ਦਾ ਉਸ ਤੋਂ ਡੇਢ ਗਲਾਸ ਮਤਲਵ ਤੀਹ ਰੁਪਏ ਦਾ ਇੱਕ ਪੰਜਾਹ ਰੁਪਏ ਦੀ ਮਤਲਵ ਥੈਲੀ ਹੁੰਦੀ ਆ ਉਸ ਤੋਂ ਵੱਡੀ ਹੁੰਦੀ ਆ ਇੱਕ ਅੱਸੀ ਰੁਪਏ ਦੀ ਹੁੰਦੀ ਆ ਕਿਲੋ ਦੀ ਸੱਠ ਰੁਪਏ ਦੀ ਹਾਂਜੀ ਦੋ ਕਿਲੋ ਵੀਹ ਰੁਪਏ ਦੀ ਜਿਹੜੀ ਓਹ ਸਬਜੀ ਮੰਡੀ ਘੰਟੇ ਕਰਨ ਘੰਟੇ ਘਰ ਵਾਲੀ ਸਾਈਡ ਹਾਂਜੀ ਸਬਜੀ ਮੰਡੀ ਕੇ ਸਾਮਨੇ ਸ਼ੋਪ ਹੈ ਆਪਣੀ ਉੱਥੋਂ ਹਾਂਜੀ ਹਾਂ ਪੰਜਾਬੀ ਲੱਸੀ ਹਾਂਜੀ ਪੰਜਾਬੀ ਲੱਸੀ ਪੰਜਾਬੀ ਲੱਸੀ ਦੀ ਹੱਟੀ ਐ ਹਾਂਜੀ ਹਾਂਜੀ ਪੰਜਾ ਦਹੀਂ ਵੀ ਹੁੰਦੀ ਹੈ ਨਮ ਨਮਕ ਵਾਲੀ ਵੀ ਹੁੰਦੀ ਹੈ ਬਿਨਾ ਨਮਕ ਤੋਂ ਵੀ ਹੁੰਦੀ ਹੈ ਹਾਂਜੀ ਲੱਸੀ ਨਮਕ ਵਾਲੀ ਵੀ ਹੁੰਦੀ ਐ ਤੇ ਮਿੱਠੀ ਵੀ ਐ ਕੁਆਲਿਟੀ ਬੜੀਆ ਬੜੀਆ ਐ ਕੁਆਲਿਟੀ ਹਾਂਜੀ ਇੱਕ ਹਾਂਜੀ ਇੱਕ ਦਸ ਰੁਪਏ ਇੱਕ ਤੀਹ ਰੁਪਏ ਦਾ ਗਿਲਾਸ ਤੇ ਇੱਕ ਦਸ ਰੁਪਏ ਦਾ ਗਿਲਾਸ ਇੱਕ ਉਸ ਤੋਂ ਵੱਡੀ ਪੰਜਾਹ ਰੁਪਏ ਦਾ ਡੱਬਾ ਹੈਗਾ ਡੱਬੇ ਚ ਹੁੰਦੀ ਐ ਲੱਸੀ ਤੇ ਹਾਂਜੀ ਤੇ ਡੱਬਾ ਹੁੰਦਾ ਇਕ ਅੱਧਾ ਕਿਲੋ ਦਾ ਵੀ ਹੁੰਦਾ ਤੇ ਕਿਲੋ ਦਾ ਵੀ ਹੁੰਦਾ ਪੈਕਿੰਗ ਉਹ ਪੈਕਿੰਗ ਹੁੰਦੀ ਹੈ ਨਾ ਹਾਂਜੀ ਹਾਂਜੀ ਇੱਕ ਪਾਊਚ ਹੁੰਦਾ ਉਹ ਤਾਂ ਛੋਟਾ ਉਹ ਤੋਂ ਛੋਟਾ ਹੀ ਹੁੰਦੇ ਨਾ ਦਸ ਰੁਪਏ ਵਾਲਾ ਪਾਊਚ ਹੁੰਦਾ ਅੱਧਾ ਕਿਲੋ ਦੇ ਡੱਬੇ ਹੁੰਦੇ ਆ ਡੱਬੇ ਦੀ ਪੈਕਿੰਗ ਹੁੰਦੀ ਹੈ ਜਿਹੜੀ ਤੁਹਾਨੂੰ ਪਸੰਦ ਹੋਵੇ ਉਹ ਲੈ ਲਿਆ ਜੀ ਆ ਗਿਆ ਜੀ ਦੇਖ ਲਿਆ ਜੀ ਹਾਂਜੀ ਠੀਕ ਐ ਜੀ